ਭਾਈ ਸਾਹਿਬ ਇੱਕ ਟਰੈਵਲ ਬਾਰੇ ਪੁੱਛਣਾ ਸੀਗਾ ਵਾਗਾ ਬੋਡਰ ਜਾਣਾ ਹੈ ਅਤੇ ਉਹਦੇ ਬਾਰੇ ਖਰਚੇ ਦੀਆਂ ਡਿਟੇਲਸ ਪਤਾ ਕਰਨੀਆਂ ਸੀ ਅਸੀਂ ਛੱਬੀ ਤਰੀਕ ਨੂੰ ਛੇ ਲੋਕਾਂ ਨੇ ਜਾਣਾ ਜੀ ਅਸੀਂ ਇੱਥੋਂ ਆਪਣਾ ਚੰਡੀਗੜ੍ਹ ਤੋਂ ਨਿਕਲਾਂਗੇ ਜੀ ਸਵੇਰੇ ਤਕਰੀਬਨ ਛੇ ਵਜੇ ਜੀ ਵਾਗਾ ਬੋਡਰ ਜਾਣਾ ਹੈ ਅੰਮ੍ਰਿਤਸਰ ਅਤੇ ਫਿਰ ਉਹਦੇ ਨਾਲ ਅਗਰ ਗੋਲਡਨ ਟੈਂਪਲ ਅਤੇ ਇੱਕ ਉੱਥੇ ਵਿਰਸਾ ਹੈਗਾ ਅਤੇ ਉਹ ਦਿਖਾ ਦਿਓ ਤਾਂ ਬੈਟਰ ਰਹੇਗਾ ਚੰਡੀਗੜ੍ਹ ਸੈਕਟਰ ਇੱਕੀ ਤੋਂ ਪਿੱਕ ਕਰ ਸਕਦੇ ਹੋ ਅਤੇ ਅਸੀਂ ਜਿਹੜੀ ਕੋਸ਼ਿਸ਼ ਹੈ ਜੀ ਅਸੀਂ ਉੱਥੋਂ ਕੇ ਛੇ ਵਜੇ ਉੱਥੋਂ ਦੀ ਵਾਪਸ ਚੱਲ ਪੈਣਾ ਜੀ ਅੰਮ੍ਰਿਤਸਰ ਤੋਂ ਠੀਕ ਹੈ ਜੀ ਹਮ ਠੀਕ ਹੈ ਜੀ ਮੈਂ ਤੁਹਾਨੂੰ ਜਿੱਦਾਂ ਹੀ ਕੰਨਫਰਮ ਹੋ ਜਾਵੇਗਾ ਤਾਂ ਮੈਂ ਤੁਹਾਨੂੰ ਫੋਨ ਕਰ ਦਿਆਂਗਾ ਠੀਕ ਹੈ ਜੀ